ਬਾਈ ਅਪ੍ਰੈਲ ਉ ਦੋ ਹਜ਼ਾਰ ਪੰਜ ਤੇਈ ਸਤੰਬਰ ਦੋ ਹਜ਼ਾਰ ਅੱਠ ਤੇਰ੍ਹਾਂ ਜਨਵਰੀ ਉੱਨੀ ਸੌ ਅੱਸੀ ਅਤੇ ਚੌਦ੍ਹਾਂ ਜਨਵਰੀ ਉੱਨੀ ਸੌ ਬਤਾਲੀ ਅਤੇ ਪੰਦਰ੍ਹਾਂ ਅਗਸਤ ਉੱਨੀ ਸੌ ਪਚਵੰਜਾ